ਹੈਲੋ ਹਾਂਜੀ ਦੱਸੋ ਹਾਂਜੀ ਹਾਂਜੀ ਦੱਸੋ ਕੀ ਨਾਮ ਤੁਹਾਡੇ ਬੱਚੇ ਦਾ ਠੀਕ ਹੈ ਜੀ ਹਾਂਜੀ ਯਾਦਵੀਰ ਦੇ ਨਾ ਬਾਕੀ ਸਬਜੈਕਟਾਂ ਚੋਂ ਤਾਂ ਠੀਕ ਆ ਸਾਰਿਆਂ ਚੋਂ ਵਧੀਆ ਨੰਬਰ ਆਏ ਆ ਪਰ ਮੈਥ ਚੋਂ ਵੀਕ ਹੈ ਕਾਫ਼ੀ ਤੁਸੀਂ ਟਿਊਸ਼ਨ ਟਾਸ਼ਨ ਨਹੀਂ ਰਖਵਾਈ ਇਹਦੀ ਘਰ ਤੁਸੀਂ ਆਪ ਵੀ ਟਾਈਮ ਦਿੰਦੇ ਬੱਚੇ ਨੂੰ ਕਿ ਨਹੀਂ ਨਹੀਂ ਜੋਰ ਅਸੀਂ ਟੀਚਰ ਦਾ ਜੋਰ ਇਨਾ ਨਹੀਂ ਹੁੰਦਾ ਤੁਸੀਂ ਘਰ ਗਏ ਤਾਂ ਧਿਆਨ ਰੱਖਿਆ ਕਰੋ ਨਾ ਵਰਕ ਦਿੱਤਾ ਵਰਕ ਤੁਸੀਂ ਡਾਇਰੀ 'ਤੇ ਕੰਪਲੀਟ ਕਰਵਾਉਣੀ ਹੁੰਦੀ ਹੈ ਸਾਡਾ ਕੰਮ ਇਥੋਂ ਡਾਇਰੀ ਵਰਕ ਚੈੱਕ ਕਰਨਾ ਕੰਮ ਦੇਣਾ ਬਾਕੀ ਤੁਸੀਂ ਦੇਖਣਾ ਹੁੰਦਾ ਮੈਥ 'ਤੇ ਥੋੜ੍ਹਾ ਫੋਕਸ ਕਰਨ ਦਾ ਮੈਥ 'ਤੇ ਥੋੜ੍ਹਾ ਅਗਾਹਾਂ ਵਾਸਤੇ ਫੋਰਸ ਕਰਿਓ ਅਤੇ ਆਹ ਲਓ ਤੁਹਾਡੇ ਬੱਚੇ ਦਾ ਰਿਜਲਟ ਅਤੇ ਅਗਾਹਾਂ ਤੋਂ ਇਹਦਾ ਧਿਆਨ ਰੱਖਣਾ ਤੁਸੀਂ ਹਾਂਜੀ ਵਧੀਆ ਓਕੇ ਜੀ ਥੈਂਕ ਯੂ